ਆਪਾਂ ਜਿਵੇਂ ਦੇਖ ਹੀ ਸਕਦੇ ਆ ਵੀ ਇੰਡੀਆ ਦੇ ਬੈਂਕ ਦੇ ਵਿੱਚ ਕੀ ਹੈਗਾ ਗਾ ਬਹੁਤ ਸਾਰੀਆਂ ਫੈਸਿਲਟੀਜ ਦਿੱਤੀਆਂ ਜਾਂਦੀਆਂ ਹੈਗੀਆਂ ਇੰਡੀਆ ਦੇ ਲੋਕਾਂ ਨੂੰ ਹੋਰ ਕੰਟਰੀਜ਼ ਦੇ ਵਿੱਚ ਕੀ ਹੋਰ ਕੰਟਰੀਜ਼ ਦੇ ਬੈਂਕ ਵੀ ਹੈਗੇ ਆ ਜਿਹੜੇ ਉਹ ਬਹੁਤ ਸਾਰੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਹੈਗੇ ਹੈਗੇ ਉੱਥੋਂ ਦੇ ਜਿੱਥੋਂ ਦੇ ਸਟੇਟਸ ਤੇ ਲੋਕ ਹੈਗੇ ਆ ਉਹਨਾਂ ਨੂੰ ਫਿਸ਼ਲਟੀਜ ਵਗੈਰਾ ਦਿੰਦਾ ਜਿਵੇਂ ਕਿ ਆ ਆਪਾਂ ਵੇਖਦੇ ਹੈਗੇ ਐਗੇ ਵੀ ਜਿਵੇਂ ਅਲਾਉਂਸਸ ਵਗੈਰਾ ਦੇਤੇ ਪੈਨਸ਼ਨ ਵਗੈਰਾ ਦੇਤੀ ਠੀਕ ਹੈ ਅਨਪਲੋਇਡ ਨੂੰ ਅਲਾਉਂਸਸ ਵਗੈਰਾ ਦੇ ਤੇ ਠੀਕ ਹੈ ਓਲਡਏਜ ਪੈਨਸ਼ਨਜ਼ ਵਗੈਰਾ ਹੋ ਗਈਆਂ ਇਹ ਸਾਰੀਆਂ ਹੈਗੀਆਂ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਇਹ ਇੰਡੀਆ ਦੇ ਬੈਂਕ ਵੀ ਤੇ ਹੋਰ ਸਟੇਟਸ ਦੇ ਬੈਂਕ ਵੀ ਕੀ ਹੈਗੇ ਆ ਫੈਸਲਟੀ ਦਿੰਦੇ ਹੈਗੇ ਹੈਗੇ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਠੀਕ ਹ ਐਡ ਮੈਂ ਜਿਵੇਂ ਆਪਾਂ ਵੇਖਦੇ ਹੈਗੇ ਆਗੀ ਵੀ ਜਦੋਂ ਕੋਈ ਵੀ ਬੰਦਾ ਹੈਗਾ ਆਪਾਂ ਵੇਖਦੇ ਆ ਲੋਨ ਲੈਣ ਜਾਂਦਾ ਬੈਂਕਿਸ ਬੈਂਕ ਵਗੈਰਾ ਦੇ ਵਿੱਚ ਠੀਕ ਹੈ ਉਹ ਜਿਵੇਂ ਉਥੇ ਕੰਮ ਕਰਦੇ ਹੁੰਦੇ ਕੋਈ ਵਰਕ ਵਗੈਰਾ ਠੀਕ ਹ ਵੀ ਬੰਦਾ ਲੋਨ ਲੈਣ ਜਾਂਦਾ ਹੈਗਾ ਵੀ ਉਹ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਹਗੇ ਵੀ ਉਹ ਕਲਪ ਜਾਂਦੇ ਹੈਗੇ ਐਗੇ ਕਿਉਂਕਿ ਪੇਪਰ ਵਰਕ ਜਿਆਦਾ ਹੁੰਦਾ ਲੋਨ ਲੈਣ ਦੇ ਲਈ ਠੀਕ ਹ ਤਾਂ ਉਥੇ ਕੀ ਹੈਗਾ ਐਗਾ ਵੀ ਇਹ ਹੋਣਾ ਚਾਹੀਦਾ ਬੀ ਅਗਰ ਕੋਈ ਬੰਦਾ ਲੋਨ ਲੈ ਜਾਵੇ ਤਾਂ ਉੱਥੇ ਪੇਪਰ ਵਰਕ ਘੱਟ ਹੋਣਾ ਚਾਹੀਦਾ ਹੈਗਾ ਠੀਕ ਹੈ ਤਾਂ ਕਿ ਵੀ ਜਿਹੜੇ ਉਥੇ ਕੰਮ ਕਰਦੇ ਆ ਉਹ ਵੀ ਕਲਪਨਾ ਐਂਡ ਜੋ ਲੋਨ ਲੈਣ ਜਾਂਦਾ ਉਹ ਵੀ ਮਤਲਬ ਉਹ ਨਾ ਹੋਣ ਅੱਜ ਕੱਲ ਕੀ ਹੈਗਾ ਵੀ ਜਿਵੇਂ ਜੋ ਵੀ ਪਰਸਨ ਹੁੰਦੇ ਹੈਗੇ ਬੈਂਕ ਕੋਲੋਂ ਲੋਨ ਲੈਂਦੇ ਹੈਗੇ ਐਗੇ ਠੀਕ ਹੈ ਤਾਂ ਉਹ ਵੀ ਜਿੰਨਾ ਉਹਨਾਂ ਨੇ ਲੋਨ ਲਿਆ ਹੁੰਦਾ ਹੈਗਾ ਠੀਕ ਹੈ ਉਹ ਉੱਨਾ ਲੋਨ ਵਾਪਸ ਕਰ ਦਿੰਦੇ ਹੁੰਦੇ ਹੈਗੇ ਠੀਕ ਐ ਉਹ ਕੀ ਆ ਹਮੇਸ਼ਾ ਬੈਂਕ ਦੇ ਨਾਲ ਲੋਇਲ ਬਣ ਕੇ ਰਹਿੰਦੇ ਆ ਸੋ ਬੈਂਕ ਨੂੰ ਬੈਂਕ ਵਗੈਰਾ ਨੂੰ ਵੀ ਹੋਣਾ ਚਾਹੀਦਾ ਹੈਗਾ ਵੀ ਉਹ ਅਗਰ ਸਾਡੇ ਦੇ ਲਈ ਲੋਇਲ ਹੈਗੇ ਹੈਗੇ ਠੀਕ ਹੈ ਤਾਂ ਅਸੀਂ ਉਹਨਾਂ ਨੂੰ ਹੋਰ ਫਸ਼ੈਲਿਟੀਜ ਪ੍ਰੋਵਾਈਡ ਕਰੀਏ ਠੀਕ ਹੈ ਵੀ ਕੋਈ ਲੋਨ ਲੈਣ ਜਾਂਦਾ ਤਾਂ ਫਿਕਸ ਰੇਟ ਆਫ ਇੰਟਰਸਟ ਤੇ ਉਹਨਾਂ ਨੂੰ ਲੋਨ ਦਿੰਦੇ ਹੈਗੇ ਸੋ ਇਹੀ ਕਾਰਨ ਹੈਗੇ ਵੀ ਭਾਰਤ ਦੇ ਬੈਂਕਾਂ ਦੇ ਵਿੱਚ ਕੀ ਹੈਗੀ ਐਗੀਆ ਇਹ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹੈਗੀਆਂ ਤੇ ਕੁਛ ਕ ਜਿਹੜੀਆ ਮੈਂ ਦੱਸੀਆਂ ਹੈਗੀਆਂ ਐਗੀਆਂ ਉਨਾਂ ਦੇ ਵਿੱਚ ਵੀ ਹੈਗਾ ਗਾ ਸੁਧਾਰ ਕਰਨਾ ਚਾਹੀਦਾ ਹੈਗਾ ਠੀਕ ਹੈ